ਸਤਿ ਸ਼੍ਰੀ ਅਕਾਲ ਮੈਂ ਪ੍ਰੀਆ ਜੇਕਰ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਇਹ ਪਹਿਲੇ ਦੇ ਸਮੇਂ ਨਾਲੋਂ ਬਹੁਤ ਬਦਲ ਗਈ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਥਿਤੀ ਦਾ ਪੱਧਰ ਜੋ ਹੈ ਅੱਜ ਦੇ ਸਮੇਂ ਵਿੱਚ ਬਹੁਤ ਉੱਚਾ ਹੋਇਆ ਹੈ ਸਰਕਾਰੀ ਸਕੂਲ ਦੇ ਜਿੱਥੇ ਅਸੀਂ ਗੱਲ ਕਰਦੇ ਹਾਂ ਇਸ ਦੀ ਇਮਾਰਤੀ ਇਸਦੇ ਮੈਦਾਨ ਇਸਦੇ ਅਧਿਆਪਕ ਬੱਚੇ ਇਹਨਾਂ ਸਭ ਦੇ ਵਿੱਚ ਸਰਕਾਰੀ ਸਕੂਲਾਂ ਨੂੰ ਲੈ ਕੇ ਬਹੁਤ ਸਾਰੇ ਬਦਲਾਵ ਕੀਤੇ ਗਏ ਹਨ ਜੇਕਰ ਅਸੀਂ ਸਭ ਤੋਂ ਪਹਿਲੇ ਗੱਲ ਕਰੀਏ ਇਸ ਦੀ ਇਮਾਰਤੀ ਸਥਿਤੀ ਦੀ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਵਿੱਚ ਬਹੁਤ ਸਾਰਾ ਬਦਲਾਵ ਆਏ ਹਨ ਇਮਾਰਤੀ ਇਮਾਰਤ ਇਸ ਤਰ੍ਹਾਂ ਦੀਆਂ ਬਣਾਈਆਂ ਗਈਆਂ ਹਨ ਕਿ ਇਸ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਬੱਚਿਆਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ ਇਹਦੇ ਇ ਇਸ ਵਿੱਚ ਖੇਡ ਦੇ ਨਾਲ ਨਾਲ ਕੰਪਿਊਟਰ ਲੈਬ ਕੰਪਿਊਟਰ ਲੈਬ ਸਾਇੰਸ ਲੈਬ ਅਤੇ ਹੋਰ ਵੀ ਵੱਖ ਵੱਖ ਲੈਬਾਂ ਜੋ ਉਸ ਸਕੂਲ ਵਿੱਚ ਵਿਸ਼ੇ ਹਨ ਉਹਨਾਂ ਨਾਲ ਸੰਬੰਧਿਤ ਲੈਬਾਂ ਸਕੂਲ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਹਰ ਸਬਜੈਕਟ ਦਾ ਟੀਚਰ ਉਸ ਸਕੂਲ ਵਿੱਚ ਮੁਹੱਈਆ ਕਰਵਾਇਆ ਗਿਆ ਹੈ ਅਤੇ ਅਸੀਂ ਜੇਕਰ ਅਧਿਆਪਕਾਂ ਦੀ ਗੱਲ ਕਰੀਏ ਤਾਂ ਅਧਿਆਪਕ ਵੀ ਕੋਈ ਇਵੇਂ ਨਹੀਂ ਰੱਖੇ ਜਾਂਦੇ ਉਹਨਾਂ ਦੀ ਵੀ ਪੂਰੀ ਪ੍ਰੀਕਸ਼ਾਵਾਂ ਲੈ ਕੇ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ ਯਾਨੀ ਕਿ ਜੋ ਅਧਿਆਪਕ ਹੈ ਉਹ ਇੱਕ ਵੈਲ ਐਜੂਕੇਟਡ ਪਰਸਨ ਹੈ ਉਹਨਾਂ ਲਈ ਕਈ ਤਰ੍ਹਾਂ ਦੇ ਪ੍ਰੀਖਿਆਵਾਂ ਰੱਖੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਉਤੇਰਨ ਕਰਨ ਤੋਂ ਬਾਅਦ ਹੀ ਉਹ ਇੱਕ ਵਿਅਕਤੀ ਨੂੰ ਟੀਚਰ ਨਿਯੁਕਤ ਕੀਤਾ ਜਾਂਦਾ ਹੈ ਟੀਚਰ ਨਿਯੁਕਤ ਕੀਤਾ ਜਾਂਦਾ ਹੈ ਅਤੇ ਯੋਗ ਵਿਅਕਤੀ ਹੀ ਸਕੂਲ ਵਿੱਚ ਸਕੂਲ ਵਿੱਚ ਅਧਿਆਪਕ ਲੱਗਦਾ ਹੈ ਅਤੇ ਜੇਕਰ ਅਸੀਂ ਗੱਲ ਕਰੀਏ ਇਸ ਸਰਕਾਰੀ ਸਕੂਲਾਂ ਵਿੱਚ ਜਿਹੜੀਆਂ ਇਸ ਦੀਆਂ ਇਮਾਰਤਾਂ ਹਨ ਉਸ ਦੀਆਂ ਦੀਵਾਰਾਂ ਉੱਤੇ ਆਸ ਵਿਸ਼ਿਆਂ ਦੇ ਨਾਲ ਸੰਬੰਧਿਤ ਕੋਈ ਵੀ ਉਪ ਵਿਸ਼ੇ ਨੂੰ ਦੀਵਾਰਾਂ ਉੱਤੇ ਅੰਕਿਤ ਕੀਤਾ ਜਾਂਦਾ ਹੈ ਜਿਵੇਂ ਕਿ ਜੇਕਰ ਅਸੀਂ ਮੈਥ ਦੀ ਗੱਲ ਕਰੀਏ ਤਾਂ ਇੱਥੇ ਮੈਥ ਦੀ ਗਿਣਤੀ ਮੈਥ ਦੀ ਗਿਣਤੀ ਨੂੰ ਉਸਦੇ ਪਿੱਲਰਾਂ 'ਤੇ ਲਿਖਿਆ ਹੁੰਦਾ ਹੈ ਅਤੇ ਮੈਥ ਦੇ ਕਈ ਫਾਰਮੂਲੇ ਹੋਰ ਵੀ ਮੈਥ ਦੀਆਂ ਵੱਖ ਵੱਖ ਚੀਜ਼ਾਂ ਉਸ ਦੀਵਾਰ 'ਤੇ ਅੰਕਿਤ ਕੀਤੀਆਂ ਗਈਆਂ ਹਨ ਅਤੇ ਜੇਕਰ ਸਾਇੰਸ ਦੀ ਗੱਲ ਕੀਤੀ ਜਾਵੇ ਤਾਂ ਸਾਇੰਸ ਲੈਬ ਦੇ ਬਾਹਰ ਵੀ ਅਤੇ ਸਾਇੰਸ ਲੈਬ ਵਿੱਚ ਵੀ ਸਾਇੰਸ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਨਮੂਨੇ ਪੇਸ਼ ਕੀਤੇ ਗਏ ਹਨ ਅਤੇ ਉਹਨਾਂ ਦੇ ਵੀ ਬੇਸਿਕ ਜਿਹੜੇ ਫਾਰਮੂਲੇ ਹਨ ਉਹ ਇਸ ਉੱਤੇ ਲਿਖੇ ਹੋਏ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਇਸ ਦੇ ਨਾਲ ਨਾਲ ਮਿੱਡ ਡੇ ਮੀਲ ਦੀ ਇੱਕ ਸੁਵਿਧਾ ਹੈ ਜੋ ਬੱਚਿਆਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਅੱਜ ਕੱਲ ਦੇ ਬੱਚੇ ਜੋ ਸਰਕਾਰ ਦਾ ਮੰਨਣਾ ਹੈ ਕਿ ਜੋ ਬੱਚਾ ਇੱਕ ਅਸਵਸਥ ਨਾ ਹੈ ਉਹ ਪੜ੍ਹਾਈ ਵਿੱਚ ਕਿਵੇਂ ਅੱਗੇ ਹੋਵੇਗਾ ਇਸ ਲਈ ਉਸ ਦੇ ਸਵਸਥ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੁਆਰਾ ਕੀ ਕੀਤਾ ਗਿਆ ਹੈ ਕਿ ਮਿੱਡ ਡੇ ਮੀਲ ਦੀ ਇੱਕ ਅ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਬੱਚਿਆਂ ਨੂੰ ਅੱਧੀ ਛੁੱਟੀ ਵੇਲੇ ਖਾਣਾ ਖੁਆਇਆ ਜਾਂਦਾ ਹੈ ਔਰ ਇਹ ਸਾਰਾ ਖਾਣਾ ਜੋ ਹੈ ਸਕੂਲ ਵਿੱਚ ਹੀ ਬਣਾਇਆ ਜਾਂਦਾ ਹੈ ਔਰ ਇਹ ਖਾਣਾ ਜੋ ਹੈ ਕੁਆਲਿਟੀ ਵਾਲਾ ਪ੍ਰੋਪਰ ਨਿਊਟਰੀਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਜਾਂਦਾ ਹੈ ਜਿਸ ਨਾਲ ਬੱਚਿਆਂ ਦੀ ਜੋ ਸਿਹਤ ਹੈ ਉਹ ਸਹੀ ਰਹੇਗੀ ਅਤੇ ਉਹ ਕੀ ਹਨ ਪੜ੍ਹਾਈ ਵਿੱਚ ਧਿਆਨ ਦੇ ਸਕਣਗੇ ਅਤੇ ਹੋਰ ਵੀ ਕਈ ਚੀਜ਼ਾਂ ਹਨ ਜਿਸ ਨੂੰ ਧਿਆ ਜਿਸ ਵਿੱਚ ਬਦਲਾਵ ਕੀਤੇ ਗਏ ਹਨ ਅਤੇ ਸਰਕਾਰੀ ਸਕੂਲਾਂ ਦੇ ਸਥਿਤੀ ਨੂੰ ਬਦਲਿਆ ਬਦਲਿਆ ਗਿਆ ਹੈ ਅਤੇ ਉਸ ਦੇ ਪੱਧਰ ਨੂੰ ਬਹੁਤ ਜ਼ਿਆਦਾ ਉੱਚਾ ਕੀਤਾ ਗਿਆ ਹੈ ਅਤੇ ਜੇਕਰ ਅਸੀਂ ਗੱਲ ਕਰੀਏ ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲਾਂ ਦੀ ਤਾਂ ਅੱਜ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਕਿਤੇ ਪਿੱਛੇ ਨਹੀਂ ਰਹੇ ਹਨ ਸਰਕਾਰ ਨੇ ਵੀ ਪੂਰਾ ਧਿਆਨ ਰੱਖਿਆ ਹੈ ਕਿ ਜੋ ਸਰਕਾਰੀ ਸਕੂਲ ਦਾ ਇੱਕ ਸਿਸਟਮ ਹੈ ਉਹ ਪੂਰੇ ਢੰਗ ਨਾਲ ਚੱਲੇ ਅਤੇ ਸਾਰੇ ਅੱਜ ਪਹਿਲੇ ਵਰਗਾ ਕੰਮ ਨਹੀਂ ਰਿਹਾ ਕਿ ਬੈ ਵਿਹਲੇ ਬੈਠ ਕੇ ਖਾਧਾ ਜਾਵੇ ਅੱਜ ਕੱਲ ਹਰ ਇੱਕ ਟੀਚਰ ਜੋ ਹੈ ਉਹ ਕੀ ਹੈ ਐਕਟਿਵ ਹੈ ਔਰ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਦਾ ਹੈ ਅਤੇ ਬਾਖੂਬੀ ਨਿਭਾਉਂਦਾ ਹੈ ਅਤੇ ਜਿਵੇਂ ਪ੍ਰਾਈਵੇਟ ਸਕੂਲ ਵਿੱਚ ਫ ਫੈਸਿਲਿਟੀਜ਼ ਹੁੰਦੀਆਂ ਹਨ ਸਰਕਾਰੀ ਸਕੂਲ ਵਿੱਚ ਵੀ ਉੱਦਾਂ ਦੀਆਂ ਫੈਸਿਲੀਟੀਆਂ ਹੁਣ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਸ ਕਰਕੇ ਜੇ ਤੁਸੀਂ ਕਹੋ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲ ਵਿੱਚ ਆਪਣਾ ਬੱਚਾ ਭੇਜਣਾ ਪਵੇ ਤਾਂ ਮੈਂ ਸੋਚਦੀ ਹਾਂ ਕਿ ਕੋਈ ਗਲਤ ਗਾਮ ਕੰਮ ਨਹੀਂ ਹੈ ਮੈਂ ਅਤੇ ਮੈਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਹੀ ਪਾਉਣਾ ਪਸੰਦ ਕਰਾਂਗੀ